ਹੈਲੋ ਗੁੱਡ ਆਫਟਰਨੂਨ ਸਰ ਆਈ ਐਮ ਟੋਕਿੰਗ ਮੈਂ ਗਿੱਲ ਗਾਰਮੈਂਟਸ ਤੋਂ ਗੱਲ ਕਰ ਰਹੀ ਹਾਂ ਹਾਂਜੀ ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ ਹਾਂਜੀ ਹਾਂਜੀ ਸਰ ਜਦੋਂ ਤੁਸੀਂ ਸਾਡੇ ਸਟੋਰ 'ਤੇ ਆਏ ਸੀ ਤਾਂ ਉਥੇ ਇੱਕ ਐਕਸਚੇਂਜ ਰੂਮ ਬਣਿਆ ਹੋਇਆ ਤੁਸੀਂ ਉਥੇ ਟ੍ਰਾਇਲ ਰੂਮ ਦੇ ਵਿੱਚ ਟਰਾਈ ਕਰਕੇ ਦੇਖਣਾ ਸੀ ਕਿ ਤੁਹਾਨੂੰ ਫਿਟਿੰਗ ਸਹੀ ਆ ਰਹੀ ਹੈ ਕਿ ਨਹੀਂ ਉਸ ਟਾਈਮ ਤੁਸੀਂ ਕਿਉਂ ਨਹੀਂ ਟਰਾਈ ਕੀਤਾ ਕਿਉਂਕਿ ਸਾਡੇ ਸਾਡੇ ਸਟੋਰ ਦਾ ਇੱਕ ਰੂਲ ਹੈ ਕਿ ਨੋ ਐਕਸਚੇਂਜ ਨੋ ਰਿਟਰਨਸ ਸੋ ਯੂ ਸੁਡ ਹੈਵ ਟਰਾਏ ਰੀਅਲ ਹਾਂਜੀ ਓਕੇ ਸਰ ਓਕੇ ਸਰ

ਹਾਂਜੀ ਓਕੇ ਸਰ ਤੁਹਾਡੇ ਕੋਲ ਸਲਿਪ ਹੋਏਗੀ ਜੋ ਤੁਹਾਨੂੰ ਦਿੱਤੀ ਗਈ ਹੋਏਗੀ ਜੋ ਰਸੀਦ ਜਿਹਨੂੰ ਬੋਲ ਦਿੰਦੇ ਆ ਉਹ ਹੋਏ ਹੋਏਗੀ ਤੁਹਾਡੇ ਕੋਲ ਅਵੇਲੇਬਲ ਓਕੇ ਨਹੀਂ ਕੋਈ ਗੱਲ ਨਹੀਂ ਸਰ ਤੁਸੀਂ ਜਦੋਂ ਵੀ ਵੇਲੇ ਹੋਵੋਗੇ ਸਾਡੇ ਸਟੋਰ 'ਤੇ ਦੁਬਾਰਾ ਆ ਜਾਇਓ ਆਪਾਂ ਦੇਖਾਂਗੇ ਕੀ ਹੋ ਸਕਦਾ ਹਾਂਜੀ ਸਰ ਹਾਂਜੀ ਸਰ ਜਦੋਂ ਮਰਜ਼ੀ ਜਦੋਂ ਮਰਜ਼ੀ ਆ ਜਿਓ ਆਪਾਂ ਆਪਾਂ ਵੱਡੇ ਜੋ ਮੇਰੇ ਤੋਂ ਉੱਪਰ ਹੈਗੇ ਨੇ ਮੈਨੇਜਰ ਉਹਨਾਂ ਨਾਲ ਗੱਲ ਕਰ ਲਾਂਗੇ ਤੁਹਾਡੀ ਪ੍ਰੋਬਲਮ ਦਾ ਸਲਿਊਸ਼ਨ ਕਰ ਦਿਆਂਗੇ ਹਾਜੀ ਓਕੇ ਥੈਂਕ ਯੂ ਸਰ ਓਕੇ ਬਾਏ